ਹਾਂ ਮੈਂ ਆਪਣੇ ਮਨਪਸੰਦ ਫੋਟੋਗ੍ਰਾਫਰ ਨੂੰ ਜਾਣਦੀ ਹਾਂ ਅਤੇ ਮੇਰਾ ਮਨਪਸੰਦ ਫੋਟੋਗ੍ਰਾਫ ਮੇਰਾ ਭਰਾ ਹੈ ਮੇਰੇ ਭਰਾ ਬਹੁਤ ਹੀ ਵਧੀਆ ਫੋਟੋਗ੍ਰਾਫਰ ਹੈ ਇੱਕ ਦਿਨ ਮੁਕਾਬਲਾ ਕੀਤਾ ਗਿਆ ਸੀ ਅਤੇ ਮੇਰੇ ਭਰਾ ਨੂੰ ਮੈਂ ਖੁਦ ਮੋਟੀਵੇਟ ਕੀਤਾ ਕਿ ਤੂੰ ਜਾ ਕੇ ਫੋਟੋਆਂ ਖਿੱਚ ਕਿਉਂਕਿ ਇਹ ਸਾਡੇ ਪੂਰੇ ਪਰਿਵਾਰ ਦੀ ਬਹੁਤ ਹੀ ਵਧੀਆ ਫੋਟੋਗ੍ਰਾਫੀ ਕਰਦਾ ਸੀ ਅਤੇ ਇੱਥੇ ਇੱਕ ਮੁਕਾਬਲਾ ਰੱਖਿਆ ਗਿਆ ਸੀ ਜਿਸ ਵਿੱਚ ਮੇਰਾ ਭਰਾ ਨੇ ਪਾਰਟੀਸਪੇਟ ਕੀਤਾ ਅਤੇ ਉਸਦੇ ਵਿੱਚ ਉਹ ਪਹਿਲੇ ਸਥਾਨ 'ਤੇ ਆਇਆ ਇੰਨੀਆਂ ਜ਼ਿਆਦਾ ਕਲੈਰਿਟੀ ਐਚ ਡੀ ਉਸਨੇ ਫੋਟੋਗ੍ਰਾਫੀ ਕੀਤੀ ਅਤੇ ਇੰਨੀਆਂ ਵਧੀਆ ਫੋਟੋਆਂ ਖਿੱਚੀਆਂ ਕਿ ਸਾਰਿਆਂ ਦਾ ਦਿਲ ਖਿੱਚ ਖਿੱਚ ਨਿਕਲੀਆਂ ਫਿਰ ਉਸ ਨੇ ਉਸ ਨੂੰ ਮੇਰੀ ਫੋਟੋ ਖਿੱਚੀ ਫਿਰ ਜਿੱਥੇ ਵੀ ਵਿਆਹ ਸ਼ਾਦੀ ਵਿੱਚ ਅਸੀਂ ਜਾਂਦੇ ਤਾਂ ਮੇਰੀ ਪੂਰੀ ਫੈਮਿਲੀ ਅਤੇ ਰਿਸ਼ਤੇਦਾਰ ਸਾਰਿਆਂ ਤੋਂ ਹੀ ਫੋਟੋਗ੍ਰਾਫੀ ਮੇਰਾ ਖੁਦ ਦਾ ਮਨਪਸੰਦ ਭਰਾ ਹੀ ਕਰਦਾ ਹੈ ਇਸ ਲਈ ਫਿਰ ਮੈਨੂੰ ਹੋਰ ਕਿਸੇ ਫੋਟੋਗ੍ਰਾਫ ਦੀ ਖਿੱਚੀ ਹੋਈ ਫੋਟੋ ਨਹੀਂ ਪਸੰਦ ਆਉਂਦੀ ਉਸ ਦੁਆਰਾ ਖਿੱਚੀ ਹੋਈ ਫੋਟੋ ਦੀ ਇਕੱਲੀ ਇਕੱਲੀ ਚੀਜ਼ ਅਤੇ ਕੋਈ ਹਰ ਇੱਕ ਪਿਕਸਲ ਬਿਲਕੁਲ ਕਲੀਅਰ ਹੈ ਫੁੱਲ ਐਚ ਡੀ 'ਚ ਵਧੀਆ ਫੋਟੋਗ੍ਰਾਫੀ ਕਰਦਾ ਹੈ ਕਿਸੇ ਵੀ ਵਿਆਹ ਸ਼ਾਦੀ ਕੋਈ ਫੰਕਸ਼ਨ ਕੋਈ ਵੀਡੀਓ ਐਡੀਟਿੰਗ ਤਾਂ ਮੈਂ ਆਪਦੇ ਮਨ ਉਸ ਮਨਪਸੰਦ ਫੋਟੋਗ੍ਰਾਫ ਆਪਣੇ ਭਰਾ ਤੋਂ ਹੀ ਕਰਵਾਉਂਦੀ ਹਾਂ ਕੋਈ ਵੀ ਵੀਡੀਓ ਬਣਵਾਉਣੀ ਹੋ ਆਸ ਪਾਸ ਦੇ ਗੁਆਂਡ ਚੋਂ ਕੋਈ ਵੀ ਉਸਦਾ ਦੋਸਤ ਮਿੱਤਰ ਹੈ ਤਾਂ ਉਹ ਉਸੇ ਨੂੰ ਹੀ ਫੋਟੋਗ੍ਰਾਫੀ ਕਰਨ ਲਈ ਕਹਿੰਦਾ ਹੈ ਫਿਰ ਅਸੀਂ ਮੇਰੇ ਭਰਾ ਨੇ ਇੱਕ ਆਪਣੀ ਦੁਕਾਨ ਖੋਲੀ ਫਿਰ ਉਸਦੇ ਉਸ ਨੇ ਉਹਦੇ ਵਿੱਚ ਆਪਣੀ ਫੋਟੋਗ੍ਰਾਫੀ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਤਰੱਕੀ ਹੋਈ ਇਸ ਰਾਹ 'ਤੇ ਅਤੇ ਐਨ ਉਸ ਦੀਆਂ ਖਿੱਚੀਆਂ ਹੋਈਆਂ ਤਸਵੀਰਾਂ ਇੰਨੀਆਂ ਹੀ ਜ਼ਿਆਦੇ ਵਧੀਆ ਲੋਕਾਂ ਦੁਆਰਾ ਪਸੰਦ ਕੀਤੀਆਂ ਗਈਆਂ ਕਿ ਉਸਦੇ ਦੁਕਾਨ ਕਿੱਥੇ ਤੋਂ ਕਿੱਥੇ ਪਹੁੰਚ ਗਈ ਅਤੇ ਹੁਣ ਉਹ ਅੱਜ ਬਹੁਤ ਹੀ ਜ਼ਿਆਦਾ ਵਧੀਆ ਫੋਟੋਗ੍ਰਾਫਰ ਹੈ ਇਸ ਤੋਂ ਇਲਾਵਾ ਜਿੰਨੇ ਵੀ ਜ਼ਿਆਦਾ ਕੰਪੀਟੀਸ਼ਨ ਹੁੰਦੇ ਆ ਫੋਟੋਗ੍ਰਾਫੀ ਨਾਲ ਰਿਲੇਟਡ ਤਾਂ ਉਹ ਹਮੇਸ਼ਾ ਫਸਟ ਹੀ ਆਉਂਦਾ ਹੈ ਇਸ ਲਈ ਉਹ ਸਭ ਵਧੀਆ ਫੋਟੋਗ੍ਰਾਫਰ ਬਣ ਚੁੱਕਾ ਹੈ ਅੱਜ ਉਸ ਦੀ ਦੁਕਾਨ ਬਹੁਤ ਹੀ ਜ਼ਿਆਦੇ ਵਧੀਆ ਪਹੁੰਚ ਗਈ ਉਸਨੇ ਆਪਣਾ ਸਭ ਕੁਝ ਖੋਲਿਆ ਹੁਣ ਉਸ ਤੋਂ ਬਹੁਤ ਹੀ ਦੂਰ ਦੂਰ ਤੋਂ ਲੋਕ ਆਉਂਦੇ ਹਨ ਉਸ ਤੋਂ ਸਪੈਸ਼ਲੀ ਫੋਟੋਗ੍ਰਾਫੀ ਕਰਵਾਉਣ ਅਤੇ ਉਹ ਬਹੁਤ ਹੀ ਵਧੀਆ ਅਤੇ ਸੋਹਣੀਆਂ ਸੋਹਣੀਆਂ ਪਿਕਚਰਾਂ ਫੋਟੋ ਵੀਡੀਓ ਬਣਾਉਂਦਾ ਹੈ